ਟੈਕਨੋਲਜੀ ਨੇ ਬਹੁਤ ਹੀ ਸਾਡੀ ਜ਼ਿੰਦਗੀ ਨੂੰ ਬਦਲਿਆ ਹੈ ਅੱਜ ਦੇ ਯੁੱਗ ਵਿੱਚ ਕੋਈ ਵੀ ਕੰਮ ਹੈ ਜਿਵੇਂ ਮੋਬਾਈਲ ਦੇ ਰਿਚਾਰਜ ਕਰਨਾ ਕਸਟਮਰ ਕੋਲੋਂ ਪੈਸੇ ਲੈਣਾ ਜਿਵੇਂ ਗੂਗਲ ਪੇ ਅੱਜ ਕੱਲ੍ਹ ਚੱਲ ਪਏ ਨੇ ਕਈ ਤਕਨੀਕਾਂ ਨੇ ਕਿ ਜਿਹੜੀਆਂ ਡਿਜੀਟਲ ਪੇਮੈਂਟ ਨਾ ਵਿਕਾਸ ਹੋ ਰਿਹਾ ਹੈ ਉਸ ਤੋਂ ਇਲਾਵਾ ਜੇ ਅਸੀਂ ਕੋਈ ਵੀ ਫੀਸ ਸਿਨੇਮਾ ਘਰ ਦੀਆਂ ਟਿਕਟਾਂ ਬੁੱਕ ਕਰਾਉਣੀਆਂ ਹੁੰਦੀਆਂ ਹੈ ਤਾਂ ਉਹ ਵੀ ਘਰ ਬੈਠੇ ਹੀ ਬੁੱਕ ਕਰ ਸਕਦੇ ਹੈ ਗੱਡੀ ਦੀਆਂ ਟਿਕਟਾਂ ਬੁੱਕ ਕਰਾਉਣੀਆਂ ਉਹ ਵੀ ਅਸੀਂ ਘਰ ਬੈਠੇ ਹੀ ਬੁੱਕ ਕਰਾ ਸਕਦੇ ਹਾਂ ਕਿਸੇ ਨੂੰ ਬਾਹਰ ਪੈਸੇ ਭੇਜਣੇ ਹੈ ਉਹ ਵੀ ਸਾਡੇ ਲਈ ਕੰਮ ਘਰ ਬੈਠੇ ਹੀ ਸਾਰੇ ਹੋ ਜਾਂਦੇ ਹਨ ਇਹ ਤੋਂ ਇਲਾਵਾ ਕੋਈ ਮਨੋਰੰਜਨ ਦੀਆਂ ਚੀਜ਼ਾਂ ਦੇਖਣੀਆਂ ਹੈ ਉਹ ਵੀ ਸਾਡੇ ਹੱਥ 'ਚ ਮੋਬਾਈਲ ਫੋਨ ਉਪਲੱਬਧ ਹਨ ਤਾਂ ਅਸੀਂ ਉਹਦੇ ਥਰੂ ਕਰ ਸਕਦੇ ਹਾਂ ਉਸ ਤੋਂ ਇਲਾਵਾ ਜੇ ਸਾਨੂੰ ਕੋਈ ਵੀ ਲੋੜ ਕੋਈ ਹਿ ਹਿਸਟਰੀ ਕਿਸੇ ਚੀਜ਼ ਦੀ ਕੱਢਣੀ ਹੈ ਜਾਂ ਕੋਈ ਇਤਿਹਾਸ ਬਾਰੇ ਜਾਨਣਾ ਹੈ ਜਾਂ ਕਿਸੇ ਵੀ ਜਗ੍ਹਾ ਬਾਰੇ ਜਾਨਣਾ ਹੈ ਤਾਂ ਸਾਨੂੰ ਉਹਦੇ ਲਈ ਕੋਈ ਕਿਸੇ ਕੋਲੋਂ ਪੁੱਛਣ ਦੀ ਲੋੜ ਨਹੀਂ ਹੈ ਹੱਥ ਵਿੱਚ ਮੋਬਾਇਲ ਫੋਨ ਹੈ ਤੁਸੀਂ ਟੈਕਨੋਲਜੀ ਦੇ ਰਾਹੀਂ ਉਹ ਸਭ ਕੁਝ ਭਾਲ ਸਕਦੇ ਹੋ ਅਖ਼ਬਾਰ ਖਰੀਦਣ ਦੀ ਉਹ ਅੱਜ ਕੱਲ੍ਹ ਤੁਹਾਨੂੰ ਲੋੜ ਨਹੀਂ ਹੈ ਜੇ ਤੁਹਾਨੂੰ ਕੋ ਕੁਝ ਵੀ ਨਿਊਜ਼ ਜਾਂ ਖ਼ਬਰ ਚਾਹੀਦੀ ਹੈ ਤਾਂ ਉਹ ਤੁਸੀਂ ਮੋਬਾਇਲ ਥਰੂ ਉਹ ਕੱਢ ਸਕਦੇ ਹੋ ਪੜ੍ਹ ਸਕਦੇ ਹੋ ਅਤੇ ਅੱਗੇ ਵੀ ਦੱਸ ਸਕਦੇ ਹੋ ਟੈਕਨੋਲਜੀ ਨੇ ਹਰ ਕੰਮ ਨੂੰ ਆਸਾਨ ਕੀਤਾ ਹੈ ਹਰ ਕੰਮ ਤੋਂ ਇਹ ਮਾੜੇ ਤੋਂ ਲੈ ਕੇ ਹਾਈਫਾਈ ਬੰਦੇ ਲਈ ਵੀ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਤੋਂ ਇਲਾਵਾ ਜੇ ਟੈਕਨੋਲੋਜੀ ਦੀ ਗੱਲ ਕੀਤੀ ਜਾਵੇ ਅੱਜ ਦਾ ਯੁੱਗ ਹੀ ਟੈਕਨੋਲੋਜੀ ਦਾ ਯੁੱਗ ਰਹਿ ਜਾ ਹੈ ਮ ਜੋ ਟੈਕਨੋਲੋਜੀ ਨੂੰ ਨਹੀਂ ਅਪਣਾਵੇਗਾ ਉਹ ਬੰਦਾ ਹਮੇਸ਼ਾ ਹੀ ਪਿੱਛੇ ਰਹਿ ਜਾਵੇਗਾ ਕਿਉਂਕਿ ਟੈਕਨੋਲਜੀ ਹੀ ਅੱਜ ਕੱਲ੍ਹ ਸਭ ਦਾ ਵਿਕਾਸ ਦਰ ਬਣੀ ਹੈ ਕਿਉਂਕਿ ਹਰ ਕੰਮ ਜੋ ਹੈ ਬੱਚੇ ਤੋਂ ਲੈ ਕੇ ਬੁੱਢੇ ਤੱਕ ਕੋਈ ਵੀ ਚੀਜ਼ ਕੋਈ ਵੀ ਕੰਮ ਅੱਜ ਕੱਲ੍ਹ ਕਰਾਉਣਾ ਹੈ ਤਾਂ ਉਹ ਟੈਕਨੋਲੋਜੀ ਥਰੂ ਹੀ ਹੋਣਾ ਹੈ ਇਸ ਤੋਂ ਇਲਾਵਾ ਇਹ ਇੰਨੀਆਂ ਆਸਾਨੀਆ ਆ ਚੁੱਕੀਆਂ ਹਨ ਹਨ ਟੈਕਨੋਲੋਜੀ ਦੇ ਰਾਹੀਂ ਹਰ ਕੰਮ ਹਰ ਜਗ੍ਹਾ 'ਤੇ ਹੀ ਟੈਕਨੋਲਜੀ ਦੀ ਵਰਤੋਂ ਹੋ ਰਹੀ ਹੈ